ਦੌੜਨਾ ਦੌੜਨਾ ਵਿਦਿਆਰਥੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਦੌੜਨਾ ਵਿਦਿਆਰਥੀ ਲਈ ਵਿਦਿਆਰਥੀ ਦੀ ਸਿਹਤ ਲਈ ਵਿਦਿ ਵਿਦਿਆਰਥੀ ਦੇ ਮਾਨਸਿਕ ਗ੍ਰੋਥ ਲਈ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਦੌੜਨ ਨਾਲ ਵਿਦਿਆਰਥੀਆਂ ਵਿੱਚ ਤੇਜ਼ ਫੁਰਤੀ ਆਉਂਦੀ ਹੈ ਉਹਨਾਂ ਦਾ ਪੜਾ ਪੜ੍ਹਾਈ ਵਿੱਚ ਵੀ ਰੁਝਾਨ ਜ਼ਿਆਦਾ ਵ ਵੱਧਦਾ ਹੈ ਉਹਨਾਂ ਦਾ ਸਰੀਰਕ ਵਿਕਾਸ ਬਹੁਤ ਹੁੰਦਾ ਹੈ ਦੌੜ ਦੌੜਨਾ ਜਵਾਕਾਂ ਦੀ ਸਿਹਤ 'ਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਜਿਸ ਨਾਲ ਉਹ ਅਪ ਆਪਣਾ ਦਿਮਾਗ ਸਹੀ ਤਰੀਕੇ ਨਾਲ ਪੜ੍ਹਾਈ ਵਿੱਚ ਲਗਾ ਸਕਦੇ ਹਨ ਦੌੜਨਾ ਬ ਦੌੜਨਾ ਬੱਚੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਨਾਲ ਉਹਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਹੁੰਦਾ ਜਿਸ ਨਾਲ ਉਹ ਆਪਣੀ ਪੜ੍ਹਾਈ ਵਿੱਚ ਜ਼ਿਆਦਾ ਵਧੀਆ ਕਰ ਸਕਦਾ ਅਤੇ ਜ਼ਿਆਦਾ ਵਧੀਆ ਪੜ੍ਹਦਾ ਹੈ ਮਾਨਸਿਕਤਾ ਅਤੇ ਆਪਦੇ ਸਰੀਰਿਕ ਵਿਕਾਸ ਲਈ ਖੇਡਾਂ ਅਤੇ ਦੌੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ੍ਹ ਹਰੇਕ ਸਕੂਲ ਵਿੱਚ ਖੇ ਖੇਡਾਂ ਨੂੰ ਬਹੁਤ ਜ਼ਿਆਦਾ ਮਹੱਤ ਮਹੱਤਤਾ ਦਿੱਤੀ ਜਾਂਦੀ ਹੈ ਜਿਸ ਨਾਲ ਜਿਸ ਵਿੱਚ ਦੌੜਨਾ ਦੌੜਨਾ ਵੀ ਬਹੁਤ ਜ਼ਰੂਰੀ ਹੈ ਜੋ ਕੀ ਬੱ ਬੱਚੇ ਦਾ ਸਟੈਮੀਨਾਰ ਵਧਾਉਂਦਾ ਹੈ ਅਤੇ ਬੱਚੇ ਦੇ ਸਟੈਮੀਨਾਰ ਵੱਧਣ ਨਾਲ ਉਸਦਾ ਸਰੀਰਕ ਅਤੇ ਭੌਤਿਕ ਵਿਕਾਸ ਹੁੰਦਾ ਹੈ ਸਰੀਰਿਕ ਵਿਕਾਸ ਨਾਲ ਬੱਚੇ ਦਾ ਕੱਦ ਉਹਨਦੀ ਸਿਹਤ ਹਮੇਸ਼ਾਂ ਤੰਦਰੁਸਤ ਰਹਿੰਦੀ ਹੈ ਤੰਦਰੁਸਤ ਜੀਵਨ ਵੀ ਬਹੁਤ ਜ਼ਿਆਦਾ ਵਿਦਿਆਰਥੀ ਲਈ ਜ਼ਰੂਰੀ ਹੈ ਚੰਗੀ ਸਿਹਤ ਨਾਲ ਹੀ ਵਿਦਿਆਰਥੀ ਅੱਗੇ ਵੱਧ ਸਕਦਾ ਹੈ ਆਪ ਪੜ੍ਹਾਈ ਵਿੱਚ ਅੱਗੇ ਜਾਂਦਾ ਹੈ ਅਤੇ ਹੋਰ ਖੇਤਰਾਂ ਵਿੱਚ ਵੀ ਅੱਗੇ ਜਾਂਦਾ ਹੈ ਦੌੜ ਨਾਲ ਬੱਚੇ ਬੱਚੇ ਦੀ ਗਰੋਥ ਬਹੁਤ ਹੁੰਦੀ ਹੈ ਅਤੇ ਉਹਦਾ ਮ ਮਾਨਸਿਕ ਵਿਕਾਸ ਵੀ ਬਹੁਤ ਜ਼ਿਆਦਾ ਜਲਦੀ ਹੁੰਦਾ ਹੈ